ਨਮਸਕਾਰ ਮੇਰਾ ਨਾਮ ਪੂਜਾ ਦੇਵੀ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਔਨਲਾਈਨ ਤੁਹਾਡੇ ਕੋਲੋਂ ਇੱਕ ਬੈਡਸ਼ੀਟ ਮੰਗਵਾਈ ਸੀ ਜੋ ਕਿ ਮੈਨੂੰ ਪਸੰਦ ਨਹੀਂ ਆਈ ਕਿਉਂਕਿ ਉਹਨੂੰ ਇੱਕ ਵਾਰ ਹੀ ਵਾਸ਼ ਕਰਨ ਨਾਲ ਉਸ ਦੇ ਰੰਗ ਉਤਰ ਗਿਆ ਅਤੇ ਜੋ ਵੀ ਉਹਦੇ ਉੱਪਰ ਡਿਜ਼ਾਇਨਿੰਗ ਸੀ ਉਹ ਵੀ ਖ਼ਰਾਬ ਹੋ ਗਈ ਅਤੇ ਵਾਸ਼ ਕਰਨ ਤੋਂ ਬਾਅਦ ਚਾਦਰ ਸੁੰਗੜ ਕੇ ਛੋਟੀ ਹੋ ਗਈ ਮੈਂ ਪੂਜਾ ਕੰਪਨੀ ਦੀ ਬੈਡਸ਼ੀਟ ਮੰਗਵਾਈ ਸੀ ਪਰ ਮੈਨੂੰ ਹੋਰ ਕੋਈ ਕੰਪਨੀ ਦੀ ਦਿੱਤੀ ਹੋਈ ਸੀ ਫੋਨ ਵਿੱਚ ਤੁਸੀਂ ਦੱਸਿਆ ਸੀ ਦੱਸਿਆ ਹੋਇਆ ਸੀ ਕਿ ਚਾਦਰ ਦੇ ਨਾਲ ਸਿਰਹਾਣੇ ਵੀ ਇਹ ਮਿਲਣਗੇ ਲੇਕਿਨ ਉਹਦੇ ਵਿੱਚ ਕੁਛ ਵੀ ਨਹੀਂ ਸੀ ਮੈਨੂੰ ਇਸ ਲਈ ਮੈਨੂੰ ਉਹ ਚਾਦਰ ਜਾਂ ਤਾਂ ਵਾਪਿਸ ਕਰ ਲਈ ਜਾਵੇ ਜਾਂ ਮੈਨੂੰ ਇਸ ਦੇ ਪੈਸੇ ਦੇ ਦਿੱਤੇ ਜਾਣ ਧੰਨਵਾਦ